ਹੈਲੋ ਮੀਸ਼ੋ ਐਪ ਮੀਸ਼ੋ ਸਰਵਿਸ ਸੈਂਟਰ ਮੈਂ ਕਾਲੇ ਕੌਰ ਪਿੰਡ ਫਾਫੜੇ ਭਾਈ ਕੇ ਤੋਂ ਹਾਂ ਮੈਂ ਹਰ ਵਾਰ ਤੁਹਾਡੀ ਐਪ ਤੋਂ ਕੁਝ ਨਾ ਕੁਝ ਮੰਗਵਾਉਂਦੀ ਰਹਿੰਦੀ ਹਾਂ ਤੁਹਾਡੇ ਪ੍ਰੋਡਕਟ ਬਹੁਤ ਵਧੀਆ ਹੁੰਦੇ ਹਨ ਇਸ ਵਾਰ ਮੈਂ ਗਰਮੀਆਂ ਵਿੱਚ ਪਾਉਣ ਲਈ ਦੋ ਕੁੜਤੀਆਂ ਆਰਡਰ ਮੰ ਆਰਡਰ ਕੀਤੀਆਂ ਸੀ ਜਿਸ ਜੋ ਕਿ ਟਾਈਮ ਤੋਂ ਪਹਿਲਾਂ ਜੋ ਕਿ ਡਿਲੀਵਰੀ ਟਾਈਮ ਤੋਂ ਪਹਿਲਾਂ ਹੀ ਮੇਰੇ ਕੋਲ ਪਹੁੰਚ ਚੁੱਕੀਆਂ ਸਨ ਮੈਂ ਜਦੋਂ ਡਿਲੀਵਰੀ ਬੋਏ ਕੋਲ ਕੁੜਤੀਜ਼ ਡਿਲੀਵਰੀ ਲੈਣ ਗਈ ਤਾਂ ਹੁਣ ਮੈਂ ਦੇਖਿਆ ਕਿ ਉਹਨਾਂ ਸੁਭਾਅ ਬਹੁਤ ਵਧੀਆ ਸੀਗਾ ਅਤੇ ਪੈਕਿੰਗ ਬਹੁਤ ਵਧੀਆ ਸੀਗੀ ਜਦੋਂ ਮੈਂ ਘਰੇ ਆ ਕੇ ਦੇਖਿਆ ਤਾਂ ਉਹਦੇ ਵਿੱਚ ਕੁੜਤੀ ਦਾ ਕਲਰ ਬਹੁਤ ਵਧੀਆ ਸੀਗਾ ਅਤੇ ਉਹ ਮੇਰੇ ਲਈ ਬਹੁਤ ਕੰਫਟੇਬਲ ਫੀਲ ਕੰਫਟੇਬਲ ਸੀ ਸਟੱਫ ਬਹੁਤ ਵਧੀਆ ਸੀ ਉਸਦਾ ਗਰਮੀਆਂ ਵਿੱਚ ਫਾਇਦੇਮੰਦ ਇਹ ਕੱਪੜਾ ਜਿਹੜਾ ਸੀ ਜਿਹੜਾ ਤੁਹਾਡਾ ਦਿੱਤਾ ਹੋਇਆ ਸੀ ਅਤੇ ਉਹ ਬਹੁਤ ਵਧੀਆ ਸੀ ਗਰਮੀਆਂ ਵਿੱਚ ਕੰਫਟੇਬਲ ਸੀਗਾ ਮੈਨੂੰ ਵੈਸੇ ਹਰ ਇੱਕ ਕਰ ਕੱਪੜਾ ਕੰਫਟੇਬਲ ਨਹੀਂ ਫੀਲ ਹੁੰਦਾ ਇਸ ਲਈ ਮੈਨੂੰ ਜਿਹੜਾ ਤੁਹਾਡਾ ਦਿੱਤਾ ਹੋਇਆ ਕੱਪੜਾ ਸੀ ਕੁੜਤੀਜ਼ ਬਹੁਤ ਵਧੀਆ ਸੀਗਾ ਮੁਲਾਇਮ ਸੀਗਾ ਪਾਉਣ ਵਿੱਚ ਠੀਕ ਲੱਗਿਆ ਮੈਨੂੰ ਇਸ ਲਈ ਇਸ ਲਈ ਮੈਂ ਹਰ ਵਾਰ ਤੁਹਾਡੀ ਐਪ ਤੋਂ ਹੀ ਕੁਝ ਨਾ ਕੁਝ ਆਰਡਰ ਕਰਦੀ ਰਹਾਂਗੀ ਤੁਹਾਡਾ ਐਪ ਬਹੁਤ ਵਧੀਆ ਹੈ ਸਾਡੇ ਲਈ